ਸਾਡੀ ਰੋਜ਼ ਦੀ ਜ਼ਿੰਦਗੀ ਵਿੱਚ ਅਸੀਂ ਟੈਕਨੋਲੋਜੀ ਜਿਵੇਂ ਕਿ ਮੋਬਾਈਲ ਟੀ ਵੀ ਦੀ ਵਰਤੋਂ ਕਰਦੇ ਹਾਂ ਜੇਕਰ ਇਹ ਉਪਕਰਨ ਨਾ ਹੋਣ ਤਾਂ ਸਾਡੀ ਜ਼ਿੰਦਗੀ ਬਹੁਤ ਅਧੂਰੀ ਮੰਨੀ ਜਾਂਦੀ ਹੈ ਕਿਉਂਕਿ ਲੋਕਾਂ ਨੂੰ ਬਹੁਤ ਹੀ ਜ਼ਰੂਰਤ ਹੁੰਦੀ ਹੈ ਇਹਨਾਂ ਉਪਕਰਨਾਂ ਦੀ ਧੰਨਵਾਦ